ਪੰਜਾਬੀ ਭਾਸ਼ਾ ਪੰਜਾਬ ਵਿੱਚ ਆਮ ਤੌਰ 'ਤੇ ਹਰ ਇੱਕ ਨੂੰ ਸਮਝ ਆਉਂਦੀ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਆਰਾਮ ਨਾਲ਼ ਇਸ ਭਾਸ਼ਾ ਨੂੰ ਸਮਝਦਾ ਹੈ ਅਤੇ ਬੋਲਦਾ ਹੈ ਅਤੇ ਮੇਰੇ ਹਿਸਾਬ ਨਾਲ਼ ਹੋਰ ਭਾਸ਼ਾਵਾਂ ਅਤੇ ਪੰਜਾਬੀ ਭਾਸ਼ਾ ਨਾਲ਼ ਕੋਈ ਪ੍ਰਭਾਵ ਨਹੀਂ ਹੈਗਾ ਸਕੂਲਾਂ ਅਤੇ ਕੋਲਜਾਂ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਂਦੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈਗੀ ਆ ਪੰਜਾਬ ਵਿੱਚ ਜ਼ਿਆਦਾਤਰ ਇਹ ਹੀ ਇਸ ਬੋਲੀ ਦੀ ਵਰਤੋਂ ਕੀਤੀ ਜਾਂਦੀ ਹੈ ਸਾਨੂੰ ਮਾਣ ਆ ਵੀ ਅਸੀਂ ਪੰਜਾਬੀ ਹਾਂ ਪੰਜਾਬ ਤ ਅਤੇ ਕੋਲਜ ਸਕੂਲ ਵਿੱਚ ਇਹੀ ਭਾਸ਼ਾ ਦੀ ਜ਼ਿਆਦਾ ਵਰਤੋਂ ਹੁੰਦੀ ਆ